ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇੱਕ ਵਾਰ ਆਪਣੇ ਭੂਆ ਦੇ ਮੁੰਡੇ ਕੋਲ ਗਿਆ ਉਹ ਫ਼ੋਨ 'ਤੇ ਐਮਾਜ਼ੋਨ 'ਤੇ ਬੂਟ ਦੇਖ ਰਿਹਾ ਸੀ ਉਸ ਨੂੰ ਪੁੱਛਿਆ ਕੀ ਤੂੰ ਬੂਟ ਲੈਣੇ ਨੇ ਤਾਂ ਉਸਨੇ ਮੈਨੂੰ ਦੱਸਿਆ ਕਿ ਹਾਂ ਵਿੰਟਰ ਸੇਲ ਚੱਲ ਰਹੀ ਹੈ ਅਤੇ ਮੈਂ ਵੀ ਬੜਾ ਉਤਸ਼ਾਹਿਤ ਹੋ ਗਿਆ ਅਤੇ ਉਸਨੂੰ ਕਿਹਾ ਕਿ ਯਾਰ ਮੇਰੇ ਕੋਲ ਵੀ ਰਨਿੰਗ ਸ਼ੂਜ਼ ਨਹੀਂ ਹੈ ਤਾਂ ਆਪਾਂ ਦੋਵੇਂ ਇਕੱਠੇ ਹੀ ਔਡਰ ਕਰ ਦਿੰਦੇ ਹਾਂ ਅਤੇ ਅਸੀਂ ਦੋਨਾਂ ਨੇ ਔਡਰ ਕਰ ਦਿੱਤੇ ਅਤੇ ਜੋ ਕਿ ਅੱਠ ਸੌ ਰੁਪਏ ਦੇ ਸਨ ਅਤੇ ਉਨ੍ਹਾਂ ਦੀ ਕੰਪਨੀ ਵੀ ਪਿਊਮਾ ਸੀ ਜੋ ਕਿ ਪਾਉਣ ਵਿੱਚ ਬਹੁਤ ਹੌਲੇ ਸਨ ਅਤੇ ਪੂਰੇ ਹੀ ਸਾਈਜ਼ ਦੇ ਹਨ ਅਤੇ ਬਹੁਤ ਹੀ ਵਧੀਆ ਅਤੇ ਸੁੰਦਰ ਸਨ ਲੋਕਾਂ ਨੇ ਮੈਨੂੰ ਪੁੱਛਿਆ ਇਹ ਬੂਟ ਕਿੱਥੋਂ ਤੋਂ ਲੈ ਕੇ ਆਉਂਦੇ ਨੇ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਐਮਾਜੋਨ ਤੋਂ ਸੇਲ ਕੀਤੇ ਨੇ